ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਦਾ ਬਹੁਤ ਵਧੀਆ ਤਰੀਕਾ ਹੈ ਕਿ ਤੁਸੀਂ ਜਿਹੜੇ ਥਾਂ 'ਤੇ ਰਹਿੰਦੇ ਹੋ ਉੱਥੇ ਤੁਸੀਂ ਜਿੰਨੇ ਵੀ ਬਾਈਕ ਰਾਈਟਰਸ ਹੈਗੇ ਆ ਉਹਨਾਂ ਨੂੰ ਮਿਲੋ ਉਹਨਾਂ ਨਾਲ ਗੱਲਬਾਤ ਕਰੋ ਬਾਈਕਿੰਗ ਬਾਈਕਿੰਗ ਦੇ ਬੜੇ ਫਾਇਦੇ ਆ ਬਾਈਕਿੰਗ ਬਾਈਕਿੰਗ 'ਤੇ ਤੁਸੀਂ ਇਕੱਲੇ ਜਾ ਸਕਦੇ ਹੋ ਕਿਤੇ ਵੀ ਜਾਣਾ ਤਾ ਇਹਦੇ 'ਚ ਪੈਟਰੋਲ ਦੀ ਵੀ ਬੱਚਤ ਹੁੰਦੀ ਹੈ ਅਗਰ ਤੁਸੀਂ ਗੱਡੀ 'ਤੇ ਜਾਓਗੇ ਤਾਂ ਤੁਹਾਨੂੰ ਔਖਾ ਹੋ ਜਾਂਦਾ ਜਿਵੇਂ ਲੇਹ ਲਦਾਖ ਜਾਣਾ ਹੋਵੇ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਆ ਕਿ ਬਾਈਕਿੰਗ ਆਪਣੀ ਕਮਿਊਨਿਟੀ ਜਾਂ ਬਾਈਕਿੰਗ ਆਪਣਾ ਗਰੁੱਪ ਬਣਾ ਕੇ ਉੱਥੇ ਜਾਂਦੇ ਆ ਘੁੰਮ ਕੇ ਆਉਂਦੇ ਆ ਪਰ ਇੱਕ ਅਲੱਗ ਹੀ ਐਕਸਪੀਰੀਅੰਸ ਹੈਗਾ ਬਾਈਕਿੰਗ ਦਾ ਬਾਈਕਿੰਗ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਕਰਨੀ ਚਾਹੀਦੀ ਹੈ ਬਾਈਕਿੰਗ ਕਰਨ ਦੇ ਬਹੁਤ ਵਧੀਆ ਵੀ ਤਰੀਕੇ ਹੈਗੇ ਹੈਗੇ ਕਿ ਇਹਦੇ ਨਾਲ ਕਿ ਆਪਣਾ ਪੋਸਚਰ ਬਾਡੀ ਦਾ ਵਧੀਆ ਬਣਿਆ ਰਹਿੰਦਾ ਹੈਗਾ ਤਾਂ ਕਿ ਬਸ ਬਾਕੀ ਇਹਦਾ ਥੋੜ੍ਹਾ ਬਹੁਤ ਨੁਕਸਾਨ ਇਹ ਹੈ ਕਿ ਬੰਦਾ ਥਕਾਵਟ ਮਹਿਸੂਸ ਕਰਦਾ ਇਹਦੇ ਵਿੱਚ ਬਾਕੀ ਬਾਈਕਿੰਗ ਕਮਿਊਨਿਟੀ ਜੁਆਇਨ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਨਵੇਂ ਨਵੇਂ ਲੋਕਾਂ ਨਾਲ ਮਿਲੋ ਆਪਣੇ ਰਿਲੇਸ਼ਨ ਬਣਾਓ ਅਤੇ ਉਹ ਤੁਹਾਨੂੰ ਅਲੱਗ ਅਲੱਗ ਐਕਸਪੀਰੀਅੰਸ ਆਪਣਾ ਸ਼ੇਅਰ ਕਰਨਗੇ ਦੱਸਣਗੇ ਵੀ ਤੁਸੀਂ ਬਾਈਕਿੰਗ ਇਸ ਤਰੀਕੇ ਨਾਲ ਕਰ ਸਕਦੇ ਹੋ ਬਾਈਕਿੰਗ ਦੇ ਬੜੇ ਅੱਛੇ ਅੱਛੇ ਮੋਟਰਸਾਈਕਲ ਵੀ ਆ ਗਏ ਆ ਜੇ ਕੋਈ ਬਹੁਤ ਜ਼ਿਆਦਾ ਕੰਫਰਟੇਬਲ ਵੀ ਹੁੰਦੇ ਹੈਗੇ ਤਾਂ ਮੈਨੂੰ ਲੱਗਦਾ ਕਿ ਬਾਈਕਿੰਗ ਦਾ ਐਕਸਪੀਰੀਅੰਸ ਵੀ ਲੈਣਾ ਚਾਹੀਦਾ